ਪੰਜਾਬ ਵਿੱਚ ਤਿੰਨ ਕਿਸਮਾਂ ਦੇ ਸਕੂਲ ਹਨ ਪੰਜਾਬ ਬੋਰਡ ਸੀ ਬੀ ਐੱਸ ਈ ਬੋਰਡ ਆਈ ਸੀ ਐੱਸ ਈ ਬੋਰਡ ਹਰ ਸਕੂਲਾਂ ਦਾ ਆਪਣਾ ਵੱਖ ਵੱਖ ਪੈਟਰਨ ਹੈ ਪੰਜਾਬ ਬੋਰਡ ਜਿਸ ਵਿੱਚ ਸਾਰੇ ਸਬਜੈਕਟ ਪੰਜਾਬੀ ਵਿੱਚ ਹੁੰਦੇ ਹਨ ਅਤੇ ਸੀ ਬੀ ਐੱਸ ਈ ਆਈ ਸੀ ਐੱਸ ਈ ਵਿੱਚ ਸਾਰੇ ਸਬਜੈਕਟ ਇੰਗਲਿਸ਼ ਹੁੰਦੇ ਹਨ ਪੰਜਾਬ ਬੋਰਡ ਜਿਸ ਵਿੱਚ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਤਿੰਨ ਮਾਧਿ ਮਾਧਿਅਮ ਹੁੰਦੇ ਹਨ ਪਰ ਸੀ ਬੀ ਐੱਸ ਈ ਅਤੇ ਆਈ ਸੀ ਐੱਸ ਈ ਬੋਰਡ ਵਿੱਚ ਸਿਰਫ ਅੰਗਰੇਜ਼ੀ ਪੈਟਰਨ ਹੁੰਦਾ ਹੈ ਜਿਸ ਕਾਰਨ ਬੱਚਿਆਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜਿਹੜੇ ਵਿਦਿਆਰਥੀ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਸੀ ਬੀ ਐੱਸ ਈ ਅਤੇ ਆਈ ਸੀ ਐੱਸ ਈ ਬੋਰਡ ਵਿੱਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਹਨ ਪੰਜਾਬ ਸਰਕਾਰ ਨੇ ਪੰਜਾਬੀ ਬੋਰਡ ਨੂੰ ਕਾਫੀ ਅੱਗੇ ਪੱਧਰ 'ਤੇ ਵਧਾ ਦਿੱਤਾ ਹੈ ਉਸ ਵਿੱਚ ਕਮਜ਼ੋਰ ਵਿਦਿਆਰਥੀ ਜੋ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ ਉਹ ਵੀ ਸੌਖਾ ਪੈਟਰਨ ਹੋਣ ਕਾਰਨ ਚੰਗੀ ਤਰ੍ਹਾਂ ਪੜ੍ਹ ਸਕਦੇ ਹਨ ਬੋਰਡ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਸਕਦੇ ਹਨ ਪਰ ਅਤੇ ਸੀ ਬੀ ਐੱਸ ਈ ਅਤੇ ਆਈ ਸੀ ਐੱਸ ਈ ਬੋਰਡ ਦੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਮੈਂ ਵੀ ਟੀਚਰ ਹਾਂ ਮੈਂ ਵੀ ਪੰਜਾਬ ਬੋਰਡ ਤੋਂ ਪੜ੍ਹੀ ਹਾਂ ਪਰ ਹੁਣ ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਬੱਚਾ ਸੀ ਬੀ ਐੱਸ ਈ ਬੋਰਡ ਤੋਂ ਪੜ੍ਹੇ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਪੰਜਾਬੀ ਨੂੰ ਘੱਟ ਅਤੇ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ ਇਸ ਕਾਰਨ ਪੰਜਾਬ ਬੋਰਡ ਕਮ ਅਤੇ ਸੀ ਬੀ ਐੱਸ ਈ ਅਤੇ ਆਈ ਸੀ ਐੱਸ ਈ ਬੋਰਡ ਵਿੱਚ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ